ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਹਾਂਜੀ ਮੈਮ ਸਾਡੇ ਕੋਲ ਪੰਜਾਬੀ ਸਾਹਿਤ ਨਾਲ ਰਿਲੇਟਡ ਨੇ ਹਿੰਦੀ ਸਾਹਿਤ ਨਾਲ ਨੇ ਇੰਗਲਿਸ਼ ਸਾਹਿਤ ਨਾਲ ਰਿਲੇਟਡ ਵੀ ਨੇ ਅਤੇ ਕੋਮਪੀਟੀਟਿਵ ਐਗਜਾਮ ਦੇ ਰਿਲੇਟਿਡ ਵੀ ਸਾਰੀਆਂ ਬੁੱਕਸ ਮਿਲ ਜਾਂਦੀਆ ਹਾਂਜੀ ਜ਼ਰੂਰ ਹਾਂਜੀ ਇੱਕ ਤਾਂ ਕੇ ਵੀ ਐਸ ਮੈਦਾਨ ਦੀ ਬੁੱਕ ਆਉਂਦੀ ਹੈ ਜੀ ਪਹਿਲੇ ਪੇਪਰ ਲਈ ਹਾਂ ਉਹ ਬਹੁਤ ਵਧੀਆ ਹੈ ਨਾ ਰੈਲੀਵੈਂਟ ਵੀ ਆ ਅਤੇ ਉਹਦੇ ਚੋਂ ਮਤਲਬ ਕਾਫ਼ੀ ਮਤਲਬ ਪੇਪਰ ਲਈ ਆ ਜਾਂਦਾ ਹੈ ਇੱਕ ਸਵਰਨ ਦੀ ਆ ਜੋ ਰਾਈਟਰ ਨੇ ਉਹਨਾਂ ਦੀ ਬੁੱਕ ਵੀ ਹੈ ਹਾਂ ਵੀ ਇਹ ਤੁਸੀਂ ਲੈ ਸਕਦੇ ਹਾਂਜੀ ਮੈਮ ਜ਼ਰੂਰ ਹਾਂਜੀ ਹਾਂ ਤੁਸੀਂ ਐਡਰੈੱਸ ਦੱਸ ਦਿਓ ਅਸੀਂ ਭੇਜ ਸਕਦੇ ਹਾਂ ਜੀ ਸਪੀਡ ਪੋਸਟ ਰਾਹੀਂ ਹਾਂਜੀ ਹਾਂਜੀ ਜੀ ਇੱਕ ਬੁੱਕ ਤਾਂ ਸਾਢੇ ਚਾਰ ਸੌ ਦੀ ਹੈ ਕੇ ਵੀ ਐਸ ਮੈਦਾਨ ਵਾਲੀ ਅਤੇ ਜੋ ਪ੍ਰੀਵੀਅਸ ਈਅਰ ਵਾਲੀ ਪੇਪਰ ਵਾਲੀ ਬੁੱਕ ਆ ਉਹ ਪੰਜ ਸੌ ਰੁਪਏ ਦੀ ਹੈ ਜੀ ਹਾਂਜੀ ਦਸ ਪਰਸੈਂਟ ਛੋਟ ਮਿਲ ਜਾਵੇਗੀ ਜੀ ਹਾਂਜੀ ਓਕੇ ਓਕੇ ਮੈਮ ਓਕੇ ਮੈਮ ਠੀਕ ਹੈ ਜੀ ਜੀ ਚਾਰ ਤੋਂ ਪੰਜ ਦਿਨ ਦੇ ਵਿੱਚ ਵਿੱਚ ਤੁਹਾਡੇ ਘਰ ਆ ਜਾਣਗੀਆਂ ਹਾਂਜੀ ਤੁਸੀਂ ਮਤਲਬ ਤੁਸੀਂ ਦੱਸ ਸਕਦੇ ਹੋ ਰਾਈਟਰ ਦਾ ਨਾਮ ਅਤੇ ਬੁੱਕ ਦਾ ਨਾਮ ਤਾਂ ਅਸੀਂ ਭੇਜਦਾਂਗੇ

ਹਾਂਜੀ ਔਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੋ ਗੂਗਲ ਪੇਅ ਜਾਂ ਨੰਬਰ 'ਤੇ ਹਾਂਜੀ ਹਾਂਜੀ ਹਾਂ ਮੈਮ ਜ਼ਰੂਰ ਓ ਓਕੇ